ਭੰਗੜਾ ਸਾਡਾ ਪੰਜਾਬੀ ਲੋਕ ਨਾਚ ਹੈ ਇਹ ਪੰਜਾਬੀ ਸੱਭਿਆਚਾਰ ਅਤੇ ਸਾਡੇ ਵਿਰਸੇ ਨੂੰ ਸੰਭਾਲਣ ਅਤੇ ਜਸ਼ਨ ਵਿੱਚ ਬਹੁਤ ਹੀ ਵੱਡਾ ਯੋਗਦਾਨ ਪ੍ਰਦਾਨ ਕਰਦਾ ਹੈ ਜਿਵੇਂ ਕਿ ਪਹਿਲੀ ਇਗਜਾਮਪਲ ਮੈਂ ਜਸ਼ਨ ਵਿੱਚ ਯੋਗਦਾਨ ਪ੍ਰਦਾਨ ਕਰਨ ਬਾਰੇ ਦੱਸਾਂਗੀ ਜਿਵੇਂ ਕਿ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਫੰਕਸ਼ਨ ਮਨਾਏ ਜਾਂਦੇ ਹਨ ਜਿਵੇਂ ਕਿ ਵਿਆਹ ਦੇ ਦੌਰਾਨ ਜਾਗੋ ਲੇਡੀ ਸੰਗੀਤ ਅਤੇ ਵਿਆਹ ਦੀਆਂ ਪ੍ਰਕਿਰਿਆਵਾਂ ਦੇ ਵਿੱਚ ਮਹਿੰਦੀ ਅਤੇ ਹਲਦੀ ਦੀਆਂ ਰਸਮਾਂ ਹੁੰਦੀਆਂ ਹਨ ਜਿਹਦੇ ਵਿੱਚ ਡੀ ਜੇ ਚਲਾਏ ਜਾਂਦੇ ਹਨ ਤਾਂ ਉਹਦੇ ਵਿੱਚ ਲੋਕ ਭੰਗੜੇ ਭੰਗੜਾ ਪਾ ਕੇ ਜਸ਼ਨ ਮਨਾਉਂਦੇ ਹਨ ਇਹ ਇੱਕ ਚੰਗਾ ਯੋਗਦਾਨ ਹੈ ਵਿਰਸੇ ਦੀ ਸੰਭਾਲ ਵੀ ਭੰਗੜੇ ਦੇ ਨਾਲ ਕੀਤੀ ਜਾ ਸਕਦੀ ਹੈ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਲੋਕ ਬਹੁਤ ਭੰਗੜਾ ਪਾਉਂਦੇ ਸਨ ਅਤੇ ਇਹ ਇੱਕ ਪੰਜਾਬੀ ਲੋਕ ਨਾਚ ਵੀ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਵੀ ਸਾਂਭਿਆ ਜਾ ਸਕਦਾ ਹੈ ਕਿਉਂਕਿ ਭੰਗੜੇ ਦੇ ਦੌਰਾਨ ਪਾਈ ਜਾਣ ਵਾਲੀ ਪੋਸ਼ਾਕ ਇੱਕ ਪੰਜਾਬ ਦੇ ਪੋਸ਼ਾਕ ਨੂੰ ਦਰਸ਼ਾਉਂਦੀ ਹੈ ਇਹ ਵਿਰਸੇ ਦੀ ਸੰਭਾਲ ਕਰਨ ਵਿੱਚ ਬਹੁਤ ਹੀ ਵੱਡਾ ਯੋਗਦਾਨ ਪ੍ਰਦਾਨ ਕਰਦਾ ਹੈ ਮੈਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਭੰਗੜੇ ਵਿੱਚ ਯੋਗਦਾਨ ਲੈਂਦੇ ਹਨ ਜਿਹਦੇ ਨਾਲ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਚੀਜ਼ਾਂ ਦੇ ਵਿੱਚ ਯੋਗਦਾਨ ਲਵੇਗੀ ਤਾਂ ਕਿ ਭੰਗੜਾ ਸਾਡਾ ਇੱਕ ਹੁਣ ਤੱਕ ਵੀ ਪੰਜਾਬੀ ਲੋਕ ਨਾਚ ਬਣਿਆ ਹੋਇਆ ਹੈ ਤਾਂ ਭੰਗੜਾ ਐਰੋਬਿਕ ਮੁਕਾਬਲੇ ਪੰਜਾਬੀ ਸੱਭਿਆਚਾਰ ਵਿਰਸੇ ਦੀ ਸੰਭਾਲ ਜਸ਼ਨਾਂ ਦੇ ਯੋਗਦਾਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪ੍ਰਦਾਨ ਕਰਦਾ ਹੈ